ਮੈਂ ਅਤੇ ਮੇਰਾ ਭਰਾ ਅਕਸਰ ਹੀ ਬਾਈਕਿੰਗ ਕਰਦੇ ਰਹਿੰਦੇ ਹਾਂ ਇੱਕ ਦਿਨ ਫਿਰ ਅਸੀਂ ਸੋਚਿਆ ਕਿਉਂ ਨਾ ਕਿਸੇ ਲੰਬੀ ਯਾਤਰਾ 'ਤੇ ਜਾਈਏ ਫਿਰ ਅਸੀਂ ਸੋਚਿਆ ਕਿ ਅਸੀਂ ਦੋਨੋਂ ਅਨੰਦਪੁਰ ਸਾਹਿਬ ਮੱਥਾ ਟੇਕ ਕੇ ਅਉਂਦੇ ਹਾਂ ਨਾਲ ਅਸੀਂ ਬਹੁਤ ਸਾਰਾ ਸਮਾਨ ਲੈ ਕੇ ਗਿਆ ਲੈ ਕੇ ਗਏ ਸਰਦੀਆਂ ਦੇ ਦਿਨ ਸੀ ਇਸ ਲਈ ਕੋਟੀਆਂ ਸਵੈਟਰ ਨਾਲੇ ਗਲਬਸ ਸੋਕਸ ਵਗੈਰਾ ਅਸੀਂ ਪ੍ਰੋਪਰ ਪਾ ਕੇ ਗਏ ਨਾਲ ਇੱਕ ਹੈਲਮੇਟ ਦੀ ਵੀ ਜਿਵੇਂ ਬਾਈਕਿੰਗ ਕਰਦੇ ਹਾਂ ਆਪਾਂ ਹੈਲਮੇਟ ਵੀ ਪਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਹੈਲਮੇਟ ਵੀ ਅਸੀਂ ਪਾਇਆ ਅਤੇ ਬਾਈਕਿੰਗ ਲਈ ਜੋ ਰਸਤੇ ਦੇ ਵਿੱਚ ਸਾਨੂੰ ਜਿਹੜੀ ਜਿਹੜੀ ਚੀਜ਼ ਦੀ ਜ਼ਰੂਰਤ ਸੀ ਅਸੀਂ ਉਹ ਨਾਲ ਲੈ ਕੇ ਗਏ ਪਹਿਲਾਂ ਜਦੋਂ ਅਸੀਂ ਸਵੇਰੇ ਘਰੋਂ ਤੁਰੇ ਉਦੋਂ ਬ੍ਰੇਕਫਾਸਟ ਕੀਤਾ ਫਿਰ ਨਾਲ ਸਾਨੂੰ ਸਾਡੇ ਮੰਮਾ ਨੇ ਲੰਚ ਵਗੈਰਾ ਪੈਕ ਕਰਕੇ ਦਿੱਤਾ ਜੋ ਕਿ ਅਸੀਂ ਰਸਤੇ ਦੇ ਵਿੱਚ ਖਾ ਸਕਦੇ ਸੀ ਅਨੰਦਪੁਰ ਸਾਹਿਬ ਜਾਂਦੇ ਵਕਤ ਰਸਤੇ ਦੇ ਵਿੱਚ ਬਹੁਤ ਸਾਰੇ ਗੁਰਦੁਆਰੇ ਆਉਂਦੇ ਹਨ ਅਸੀਂ ਉਹਨਾਂ ਤੇ ਵੀ ਮੱਥਾ ਟੇਕਿਆ ਦਰਸ਼ਨ ਕੀਤੇ ਲੰਗਰ ਛਕਿਆ ਰਸਤੇ ਦੇ ਵਿੱਚ ਨੈਨਾ ਦੇਵੀ ਦਾ ਮੰਦਿਰ ਆਉਂਦਾ ਅਸੀਂ ਉੱਥੇ ਵੀ ਗਏ ਦਰਸ਼ਨ ਕੀਤੇ ਮੱਥਾ ਟੇਕਿਆ ਇਹ ਜਿਹੜਾ ਸਾਡਾ ਸਫ਼ਰ ਆ ਇਹ ਬਹੁਤ ਹੀ ਵਧੀਆ ਰਿਹਾ ਅਸੀਂ ਦੋਵੇਂ ਅਕਸਰ ਹੀ ਬਹੁਤ ਸਾਰੀਆਂ ਯਾਤਰਾਵਾਂ ਕੀਤੀਆਂ ਬਟ ਜਿਹੜਾ ਇਹ ਵਾਲਾ ਸਾਡੀ ਯਾਤਰਾ ਸੀ ਇਹ ਵਾਲਾ ਜਿਹੜਾ ਸਾਡਾ ਸਫ਼ਰ ਹੀ ਇਹ ਵਾਲੀ ਸਿਟੀ ਸਾਡੀ ਬਾਈਕਿੰਗ ਸੀਗੀ ਇਹ ਬਹੁਤ ਹੀ ਵਧੀਆ ਰਹੀ ਸਾਨੂੰ ਬਹੁਤ ਹੀ ਮਜ਼ਾ ਆਇਆ ਸਾਨੂੰ ਬਹੁਤ ਆਨੰਦ ਆਇਆ ਆਨੰਦਪੁਰ ਸਾਹਿਬ ਮੱਥਾ ਟੇਕਣ ਦਾ